ਹੈਲੋ ਸਰ ਕੀ ਤੁਸੀਂ ਪਜ਼ੇਰੀਆ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਮੇਰਾ ਨਾਮ ਜੈਦੀਪ ਹੈ ਔਰ ਮੈਂ ਇੱਕ ਔਡਰ ਪਲੇਸ ਕੀਤਾ ਸੀਗਾ ਮਨਚੂਰੀਅਨ ਦਾ ਔਰ ਫਰਾਈਡ ਰਾਈਸ ਦਾ ਔਰ ਮੇਰਾ ਔਡਰ ਆਈ ਡੀ ਨੰਬਰ ਸੀਗਾ ਵਨ ਥਰੀ ਟੂ ਫੌੌਰ ਫਾਈਵ ਸੈਵਨ ਨਾਈਨ ਏਟ ਔਰ ਮੈਂ ਕਾਫ਼ੀ ਦੇਰ ਤੋਂ ਕੋਸ਼ਿਸ਼ ਕਰ ਰਹੀ ਹਾਂ ਡਿਲੀਵਰੀ ਐਗਜੈਕਟਿਵ ਨੂੰ ਕੋਲ ਕਰਨ ਦੀ ਬਟ ਡਿਲੀਵਰੀ ਐਕਜੈਕਟਿਵ ਜਿਹੜੇ ਨੇ ਉਹ ਮੇਰਾ ਫੋਨ ਪਿੱਕ ਨਹੀਂ ਕਰ ਰਹੇ ਹੈਗੇ ਔਰ ਇਸ ਚੀਜ਼ ਨੂੰ ਆਲਮੋਸਟ ਇੱਕ ਘੰਟਾ ਹੋ ਚੁੱਕਿਆ ਔਰ ਮੈਂ ਕਾਫ਼ੀ ਦੇਰ ਤੋਂ ਵੇਟ ਕਰ ਰਹੀ ਹਾਂ ਔਰ ਮੈਂ ਪਹਿਲਾਂ ਰੈਸਟੋਰੈਂਟ ਨੂੰ ਵੀ ਟਰਾਈ ਕੀਤਾ ਸੀਗਾ ਬਟ ਉੱਧਰੋਂ ਵੀ ਮੈਨੂੰ ਕੋਈ ਜਵਾਬ ਨਹੀਂ ਆਇਆ ਸਵਿਗੀ ਵਾਲਿਆਂ ਨੂੰ ਕੋਲ ਕੀਤੀ ਸੀਗੀ ਸਵਿਗੀ ਵਾਲਿਆਂ ਦਾ ਵੀ ਕੋਈ ਰਿਸਪੋਂਡ ਕਰ ਨਹੀਂ ਰਹੇ ਹੈਗੇ ਉਹਨਾਂ ਨੇ ਕਿਹਾ ਕਿ ਜਦੋਂ ਦੁਬਾਰਾ ਕੋਲ ਕੀਤੀ ਤਾਂ ਉਹ ਸਵਿਗੀ ਵਾਲੇ ਕਹਿੰਦੇ ਕਿ ਅਸੀਂ ਡਿਲੀਵਰੀ ਐਕਜੈਕਿਟਵ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਜਿਹੜੇ ਨੇ ਉਹ ਰਸਤੇ ਦੇ ਵਿੱਚ ਨੇ ਅਤੇ ਥੋੜ੍ਹੀ ਦੇਰ ਤੱਕ ਪਹੁੰਚ ਜਾਣਗੇ ਬਟ ਹੁਣ ਜਦੋਂ ਮੈਂ ਦੁਬਾਰਾ ਡਿਲੀਵਰੀ ਐਕਜੈਕਿਟਵ ਨੂੰ ਗੱਲ ਕਰਨ ਦੀ ਜਰੂਰ ਕੋਸ਼ਿਸ਼ ਕੀਤੀ ਤਾਂ ਨਾ ਤਾਂ ਉਹ ਮੇਰਾ ਫੋਨ ਪਿੱਕ ਕਰ ਰਹੇ ਨੇ ਔਰ ਨਾ ਹੀ ਉਹਨਾਂ ਦਾ ਕੋਈ ਮੈਸੇਜ ਦੀ ਰਿਪਲਾਈ ਆ ਰਹੀ ਹੈ ਤੋ ਮੈਂ ਚਾਹੁੰਦੀ ਸੀਗੀ ਕਿ ਜਾਂ ਤਾਂ ਤੁਸੀਂ ਉਹਨਾਂ ਨੂੰ ਪੁੱਛ ਦਿਓ ਕਿ ਉਹ ਕਿੱਥੇ ਕੁ ਨੇ ਅਤੇ ਜਾਂ ਫਿਰ ਮੇਰਾ ਔਡਰ ਜਿਹੜਾ ਹੈਗਾ ਉਹ ਫਿਰ ਤੁਸੀਂ ਜਾਂ ਤਾਂ ਦੁਬਾਰਾ ਡਿਲੀਵਰ ਕਰ ਦਿਓ ਅਤੇ ਜਾਂ ਫਿਰ ਉਸਨੂੰ ਕੈਂਸਲ ਕਰ ਦਿਓ ਅਤੇ ਮੈਂ ਆਪਣਾ ਨਾਮ ਦੁਬਾਰਾ ਦੱਸ ਦਿੰਦੀ ਹਾਂ ਮੇਰਾ ਨਾਮ ਜੈਦੀਪ ਹੈ ਔਰ ਮੇਰਾ ਔਡਰ ਸੀਗਾ ਮਨਚੂਰੀਅਨ ਔਰ ਫਰਾਈਡ ਰਾਈਜ ਦਾ ਔਰ ਔਡਰ ਆਈ ਡੀ ਸੀਗਾ ਵਨ ਥਰੀ ਟੂ ਫੌੌਰ ਫਾਈਵ ਸਿਕਸ ਨਾਈਨ ਏਟ ਤੋ ਤੁਸੀਂ ਪਲੀਜ਼ ਇੱਕ ਵਾਰ ਚੈੱਕ ਕਰ ਲਓ ਫਿਰ ਮੈਨੂੰ ਦੱਸ ਦਿਓ ਅਦਰਵਾਈਜ਼ ਮੇਰਾ ਔਡਰ ਫਿਰ ਨਹੀਂ ਤਾਂ ਕੈਂਸਲ ਕਰ ਦਿਓ ਥੈਂਕ ਯੂ